ਸਤਿ ਸ਼੍ਰੀ ਅਕਾਲ ਜੀ ਮੈਂ ਅਵਨੀਸ਼ ਕੁਮਾਰ ਪਿੰਡ ਕੋਟਲਾ ਰੋਪੜ ਤੋਂ ਬੋਲਦਾ ਜੀ ਮੈਨੂੰ ਅਗਲੇ ਹਫਤੇ ਆਪਣੇ ਪਰਿਵਾਰ ਨਾਲ ਸ਼ਿਮਲੇ ਘੁੰਮਣ ਜਾਣ ਦੀ ਚਾਹਵਾਨ ਹੈਗੇ ਆ ਅਸੀਂ ਅਤੇ ਅਸੀਂ ਸਾਰਾ ਪਰਿਵਾਰ ਘੁੰਮਣ ਜਾਣ ਦੇ ਪ੍ਰੋਗਰਾਮ ਬਣਾਇਆ ਹੈ ਅਤੇ ਸਾਨੂੰ ਛੋਟੀ ਕੈਬ ਜਿਹੜੀ ਅਸੀਂ ਕਿੰਨਾਂ ਖਰਚਾ ਆਏਗਾ ਏ ਛੇ ਮੈਂਬਰਾਂ ਵਾਸਤੇ ਕੀ ਖਰਚਾ ਆਏਗਾ ਅਤੇ ਅਸੀਂ ਜਾਣਾ ਹੈਗਾ ਸ਼ਿਮਲੇ ਅਤੇ ਅਸੀਂ ਆਉਂਦੇ ਹੋਏ ਰਸਤੇ ਵਿੱਚ ਰੁਕਣਾ ਵੀ ਚਾਹੁੰਦੇ ਹਾਂ ਜਿੱਦਾਂ ਕਸੌਲੀ ਘੁੰਮ ਕੇ ਆਉਣਾ ਚਾਹੁੰਦੇ ਹਾਂ ਅਤੇ ਸਾਨੂੰ ਪੰਜ ਮੈਬਰਾਂ ਵਾਸਤੇ ਕੀ ਖਰਚਾ ਪਏਗਾ ਉੱਥੇ ਸਟੇਅ ਕਰਨ ਦਾ ਛੇ ਮੈਂਬਰਾਂ ਦਾ ਵਾਲੀ ਗੱਡੀ ਦਾ ਕੀ ਖਰਚਾ ਪਏਗਾ ਸਾਨੂੰ ਥੋੜ੍ਹਾ ਜਾ ਦੱਸਿਆ ਜਾਵੇ ਤਾਂ ਜੋ ਅਸੀਂ ਤੁਹਾਡੀ ਕੈਬ ਬੁੱਕ ਕਰਵਾ ਸਕੀਏ